ਮੈਨੂੰ ਸਭ ਤੋਂ ਵੱਧ ਜਿਹੜੀਆਂ ਬੁਣੀਆਂ ਜਾਣ ਵਾਲੀਆਂ ਚੀਜ਼ਾਂ ਨੇ ਉਸ ਦੇ ਵਿੱਚ ਛੋਟੇ ਬੱਚਿਆਂ ਦੀ ਸਵੈਟਰ ਅਤੇ ਲੇਡੀਜ ਸਵੈਟਰ ਬੁਣਨ ਦਾ ਕਾਫ਼ੀ ਸ਼ੌਕ ਆ ਜੇਕਰ ਸਿਲਾਈ ਦੀ ਗੱਲ ਕਰੀਏ ਉਹਦੇ ਵਿੱਚ ਵੀ ਸੇਮ ਆ ਜੀ ਮੈਂ ਛੋਟੇ ਬੱਚਿਆਂ ਦੀਆਂ ਜਿੱਦਾਂ ਫਰੋਕ ਹੋ ਗਈਆਂ ਛੋਟੇ ਛੋਟੇ ਉਹਨਾਂ ਦੇ ਕੱਪੜੇ ਹੋ ਗਏ ਪਜਾਮੀਆਂ ਉਹ ਅਤੇ ਉਹਨਾਂ ਦੀ ਸ਼ਰਟ ਆ ਇੱਦਾਂ ਦਾ ਬਣਾਉਣ ਦਾ ਸ਼ੌਂਕ ਆ ਅਤੇ ਸਿਲਾਈ ਦੇ ਵਿੱਚ ਦੇ ਨਾਲ ਹੀ ਮੈਨੂੰ ਲੇਡੀਜ ਸੂਟ ਨੇ ਜਿਹੜੇ ਉਹ ਸਭ ਤੋਂ ਵੱਧ ਸਿਲਾਈ ਕਰਨੇ ਪਸੰਦ ਨੇ ਅਤੇ ਇਹਦੇ ਵਿੱਚ ਵਿਲੱਖਣ ਜੇਕਰ ਤਕਨੀਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਆ ਕਿ ਜੇ ਲੇਡੀਜ ਸੂਟ ਦੇ ਵਿੱਚ ਜਿੱਦਾਂ ਕਿ ਅਸੀਂ ਕਟਿੰਗ ਕਰਕੇ ਅਤੇ ਮੈਂ ਸਲਵਾਰਾਂ ਵਗੈਰਾ ਨੇ ਜਿਹੜੀਆਂ ਉਹ ਬਾਹਰੋਂ ਸਟਿੱਚ ਕਰਵਾ ਲੈਂਦੀ ਹਾਂ ਅਤੇ ਸ਼ਰਟ ਆਪ ਜਿਹੜਾ ਕਮੀਜ਼ ਉਹ ਆਪ ਤਿਆਰ ਕਰ ਲੈਂਦੀ ਹਾਂ ਅਤੇ ਕਮੀਜ਼ ਦੇ ਵਿੱਚ ਵੀ ਜਦੋਂ ਰੈਡੀ ਹੋ ਜਾਂਦਾ ਉਹਦੇ ਲਈ ਅਸੀਂ ਉਹਦੀ ਤਰਪਾਈ ਵਗੈਰਾ ਜਿਹੜੀ ਉਹ ਬਾਹਰੋਂ ਕਰਵਾ ਲੈਂਦੇ ਹਾਂ ਅਤੇ ਉਹਦੀ ਜਿਹੜੀ ਪ੍ਰੈੱਸ ਆ ਉਹ ਵੀ ਬਾਹਰੋਂ ਕਰਵਾ ਸਕਦੇ ਹਾਂ ਇਸ ਤਰ੍ਹਾਂ ਕਿ ਜਿਹੜੇ ਸਿਲਾਈ ਦਾ ਕੰਮ ਆ ਉਹ ਹੋਰ ਤੇਜ਼ੀ ਨਾਲ ਹੋ ਸਕਦਾ ਜੇਕਰ ਅਸੀਂ ਇਸ ਤਰ੍ਹਾਂ ਹੈਲਪ ਲੈਂਦੇ ਹਾਂ ਅਤੇ ਸਭ ਤੋਂ ਵੱਧ ਮੈਨੂੰ ਇਹ ਹੀ ਪਸੰਦ ਆ ਕਿ ਮੈਂ ਲੇਡੀਜ ਸੂਟ ਆ ਜਿਹੜਾ ਉਹ ਵੱਧ ਤੋਂ ਵੱਧ ਡਿਜ਼ਾਇਨਾਂ ਦੇ ਨਾਲ ਹੈ ਨਾ ਸਟਿੱਚ ਕਰਾਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ